ਮੈਨੂੰ ਰਨਿੰਗ ਕਰਨਾ ਬਹਤ ਪਸੰਦ ਹੈ ਰਮ ਰਨਿੰਗ ਵਰਕਆਊਟ ਦੇ ਵਿੱਚ ਮੈਨੂੰ ਸਪਲੀ ਟੰਨਤਰਾਲ ਦੇ ਵਿੱਚ ਦੌੜਨਾ ਬਹੁਤ ਹੀ ਪਸੰਦ ਹੈ ਅਤੇ ਇਹ ਇੱਕੋ ਵਾਰ ਵਿੱਚ ਹੁੰਦੀ ਹੈ ਦੌੜਨ ਨੇ ਮੈਨੂੰ ਕਾਫੀ ਤੰਦਰੁਸਤ ਬਣਾਇਆ ਹੈ ਕਿਉਂ ਪਹਿਲਾਂ ਦੇ ਟਾਇਮ ਦੇ ਵਿੱਚ ਮੈਨੂੰ ਦੌੜਨਾ ਬਹੁਤ ਹੀ ਪਹਿਲਾਂ ਔਖਾ ਲੱਗਦਾ ਸੀ ਅਤੇ ਬਹੁਤ ਹੀ ਮੁਸ਼ਕਿਲ ਵੀ ਲੱਗਦਾ ਸੀ ਪਰ ਹੁਣ ਰ ਰੁਟੀਨ ਹੋਣ ਦੇ ਕਾਰਨ ਇਹ ਮੈਨੂੰ ਮੇਰੇ ਤੋਂ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਸਵੇਰੇ ਸਵੇਰੇ ਉੱਠ ਕੇ ਮੈਂ ਜ਼ਰੂਰ ਕਰਦੀ ਹਾਂ ਅਤੇ ਇਹ ਪ੍ਰੋਟੀਨ ਦੇ ਕਾਰਨ ਮੈਨੂੰ ਹੁਣ ਹੋਰਾਂ ਵਾਂਗੂ ਮੁਸ਼ਕਿਲ ਨਹੀਂ ਹੁੰਦੀ ਪਹਿਲਾਂ ਦੇ ਵਾਂਗੂ ਅਤੇ ਇਹ ਇਸ ਦੇ ਲਈ ਮੈਨੂੰ ਕਾਫੀ ਡਾਈਟ ਵੀ ਲੈਣੀ ਪੈਂਦੀ ਹੈ ਸਵੇਰੇ ਸਵੇਰੇ ਮੈਨੂੰ ਹਰ ਇੱਕ ਕੋਈ ਵੀ ਡਾਇਟ ਜਿਵੇਂ ਦੁੱਧ ਹੋ ਗਿਆ ਕੇਲਾ ਯਾਰ ਆਦਿ ਕੁਛ ਵੀ ਜੋ ਕਿ ਬੋਡੀ ਨੂੰ ਮੇਰੇ ਤੰਦਰੁਸਤ ਰੱਖੇ ਮੈਂ ਉਹ ਲੈਂਦੀ ਹਾਂ ਦੌੜਨ ਨਾਲ ਕੀ ਕਹਿੰਦੇ ਸਰੀਰ ਦੀ ਫੁਰਤੀ ਅਤੇ ਤੇਜੀ ਵਿੱਚ ਵਾਧਾ ਵੀ ਹੁੰਦਾ ਹੈ ਮੇਰੇ ਕਾਫੀ ਫਰੈਂਡਸ ਹਨ ਜੋ ਕਿ ਦੌੜ ਅ ਵਗੈਰਾ ਨਹੀਂ ਕਰਦੇ ਜਿਹਨਾਂ ਕਾਰਨ ਉਹਨਾਂ ਦੀ ਬੋਡੀ ਸਰੀਰਿਕ ਸਿੱਖਿਆ ਇੰਨੀ ਸਰੀਰਿਕ ਇੰਨੀ ਵਧੀਆ ਨਹੀਂ ਹੈ ਤਾਂ ਉਹਨਾਂ ਨੂੰ ਵੀ ਮੈਂ ਕਾਫੀ ਕਹਿੰਦੀ ਹਾਂ ਅਤੇ ਉਹ ਵੀ ਹੁਣ ਕਰਨਾ ਸ਼ੁਰੂ ਕਰ ਦਿੱਤਾ ਹੈ ਦੌੜਨਾ ਸਾਨੂੰ ਕਾਫੀ ਤੰਦਰੁਸਤ ਬਣਾਉਂਦਾ ਹੈ ਅਤੇ ਇਸ ਨਾਲ ਬਿਮਾਰੀਆਂ ਵੀ ਬਹੁਤ ਹੀ ਜ਼ਿਆਦਾ ਘੱਟ ਲੱਗਦੀ ਹੈ ਅਤੇ ਸ ਇਹ ਸਾਨੂੰ ਸਰੀਰ ਨੂੰ ਚੁਸਤ ਅਤੇ ਫੁਰਤ ਵੀ ਰੱਖਦੀ ਹੈ